ਸਾਨੂੰ ਸਾਡੇ ਮਾਤਾ ਪਿਤਾ ਅਤੇ ਦਾਦਾ ਦਾਦੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਵੱਡਿਆਂ ਦਾ ਆਦਰ ਮਾਣ ਕਰਨਾ ਚਾਹੀਦਾ ਹੈ ਓਹਨਾਂ ਨੂੰ ਚੰਗੀ ਤਰ੍ਹਾਂ ਬੁਲਾਉਣਾ ਚਾਹੀਦਾ ਹੈ ਓਹਨਾਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ ਸਾਡੇ ਮਾਤਾ ਪਿਤਾ ਅਤੇ ਦਾਦਾ ਦਾਦੀ ਸਾਨੂੰ ਇਹੀ ਸਿੱਖਿਆ ਦਿੰਦੇ ਹਨ ਅਤੇ ਓਹਨਾਂ ਨੂੰ ਵੀ ਛੋਟੇ ਹੁੰਦੇ ਓਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰਿਆਂ ਤੋਂ ਮਾਤਾ ਪਿਤਾ ਤੋਂ ਓਹਨਾਂ ਨੂੰ ਵੀ ਇਹੀ ਸਿੱਖਿਆ ਪ੍ਰਾਪਤ ਹੋਈਆਂ ਹਨ ਅੱਜ ਉਹ ਵੀ ਸਾਨੂੰ ਇਹੀ ਸਿੱਖਿਆ ਪ੍ਰਾਪਤ ਕਰਾ ਰਹੇ ਹਨ ਓਹਨਾਂ ਦੇ ਸਮੇਂ ਵਿੱਚ ਓਹਨਾਂ ਨੂੰ ਇਹ ਚੁਣੌਤੀਆਂ ਆਉਂਦੀਆਂ ਹਨ ਕਿ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਲੋਕਾਂ ਦੇ ਸੰਪਰਕ ਵਿੱਚ ਆਉਣ ਲਈ ਓਹਨਾਂ ਨੂੰ ਆਵਾਜਾਈ ਸਾਧਨਾਂ ਦੀ ਵੀ ਕਮੀ ਸੀ ਉਹ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰ ਸਕਦੇ ਸੀ ਓਹਨਾਂ ਨੂੰ ਜਾਣ ਲਈ ਵੀ ਉਹਨਾਂ ਕੋਲ ਉਹਨਾਂ ਨੂੰ ਸੰਪਰਕ ਵਿੱਚ ਆਉਣ ਲਈ ਬਹੁਤ ਜ਼ਿਆਦਾ ਦੇਰ ਵੀ ਲਗਦੀ ਸੀ ਪਰ ਹੁਣ ਦੇ ਸਮੇਂ ਵਿੱਚ ਲੋਕਾਂ ਕੋਲ ਮੋਬਾਇਲ ਫੋਨ ਸਮਾਰਟ ਫੋਨ ਆ ਚੁੱਕੇ ਹਨ ਜਿਸ ਨਾਲ ਉਹ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਰਿਸ਼ਤੇਦਾਰਾਂ ਜਾਂ ਕਿਸੇ ਸੰਪਰਕ ਸੰਪਰਕ ਵਿੱਚ ਆ ਸਕਦੇ ਹਨ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਗੱਲ ਕਰ ਸਕਦੇ ਹਨ ਉਹਨਾਂ ਨੂੰ ਇਸ ਨਾਲ ਬਹੁਤ ਜ਼ਿਆਦਾ ਆਸਾਨੀ ਹੋ ਸਕੀ ਹੈ ਆਪਣੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਆਉਣ ਲਈ